ਛੋਟੇ ਉਦਯੋਗਾਂ ਅਤੇ ਛੋਟੇ ਕਿਸਾਨਾਂ ਲਈ ਅਤੇ ਮਹਿਲਾਵਾਂ ਵਾਸਤੇ ਵੀ ਜੇ ਅਸੀਂ ਕੋਈ ਬਿਜਨਸ ਕਰਨਾ ਚਾਹੁੰਦੇ ਹਾਂ ਤਾਂ ਬਹੁਤ ਸਾਰੀ ਸਕੀਮ ਸਰਕਾਰਾਂ ਦੁਆਰਾ ਵੀ ਅਤੇ ਹੋਰ ਪ੍ਰਾਈਵੇਟ ਸੰਸਥਾਵਾਂ ਦੁਆਰਾ ਵੀ ਉਪਲਬਧ ਕਰਵਾਈ ਗਈਆਂ ਹੈ ਜਿਵੇਂ ਕਿ ਜੇ ਕਿਸਾਨ ਨੇ ਆਪਣੀ ਖੇਤੀ ਕਰਨ ਵੇਲੇ ਜੇ ਦਾਣੇ ਮਤਲਬ ਬੀਜ ਵਾਸਤੇ ਉਹਨੂੰ ਪੈਸਾ ਚਾਹੀਦਾ ਤਾਂ ਉਹ ਵੀ ਪੈਸਾ ਪ੍ਰੋਵਾਇਡ ਕੀਤਾ ਜਾਂਦਾ ਈਵਨ ਕਿ ਬੀਜ ਦੇ ਕੇ ਖਾਦ ਵਾਸਤੇ ਵੀ ਬਾਅਦ 'ਚ ਵੀ ਧਿਆਨ ਰੱਖਣ ਲਈ ਵੀ ਉਹਦੀ ਮਦਦ ਕੀਤੀ ਜਾਂਦੀ ਹੈ ਅਤੇ ਜੇ ਮਹਿਲਾ ਨੇ ਕੋਈ ਕੰਮ ਕਰਨਾ ਹੈ ਤਾਂ ਉਹਦੇ ਲਈ ਵੀ ਕਈ ਬੈਂਕ ਇੱਦਾਂ ਦੇ ਹੈਗੇ ਹੈ ਜਿਹੜੇ ਕਿ ਉਹਨਾਂ ਨੂੰ ਉਧਾਰ ਦੀ ਫੈਸੀਲੀਟੀ ਦਿੰਦੇ ਪਹਿਲਾਂ ਹੀ ਉਹਨਾਂ ਨੂੰ ਪੈਸੇ ਪ੍ਰੋਵਾਇਡ ਕਰਦੇ ਹੈ ਤਾਂ ਕਿ ਉਹ ਆਪਣਾ ਬਿਜਨਸ ਸ਼ੁਰੂ ਕਰਨ ਅਤੇ ਅੱਗੇ ਵੱਧੇ ਹਾਂ ਇੱਕ ਇੱਦਾਂ ਦੀ ਨੀਤੀ ਦੇ ਬਾਰੇ ਮੈਂ ਜਾਣਦੀ ਹਾਂ ਜਿਹੜੀ ਕਿ ਉਜਜੀਵਨ ਮਹਿਲਾ ਯੋਜਨਾ ਹੈ ਅਤੇ ਉਹਨਾਂ ਨੇ ਸ਼ੁਰੂ ਕੀਤੀ ਸੀ ਅਤੇ ਉਸਦੇ ਰਾਹੀਂ ਅਸੀਂ ਵੀ ਫਾਇਦਾ ਚੱਕਿਆ ਸੀ